ਹਾਲ ਹੀ ਵਿੱਚ ਇੱਕ ਮੈਂ ਨੋਇਜ਼ ਕੰਪਨੀ ਤੋਂ ਏਅਰਬਰਡਸ ਮੰਗਵਾਏ ਓਨਲਾਈਨ ਅਤੇ ਮੈਨੂੰ ਇਹਨਾਂ ਦੀ ਬਹੁਤ ਹੀ ਅੱਛੀ ਕੁਆਲਿਟੀ ਲੱਗੀ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਓਪਸ਼ਨਸ ਨੇ ਆਪਾਂ ਹੀ ਕੰਨ ਤੋਂ ਮਤਲਬ ਲੱਗੇ ਲੱਗੇ ਇਹਨਾਂ ਦੇ ਸੈਂਸਰ ਲੱਗੇ ਹੋਏ ਨੇ ਜਿਹਨਾਂ ਨਾਲ ਅਸੀਂ ਇਹਨਾਂ ਇਹਨਾਂ ਦੀ ਆਵਾਜ਼ ਘੱਟ ਵੱਧ ਕਰ ਸਕਦੇ ਹਾਂ ਸੌਂਗਸ ਲਗਾਏ ਤਾਂ ਚੇਂਜ ਕਰ ਸਕਦੇ ਹਾਂ ਬੈਟਰੀ ਕੁਆਲਿਟੀ ਬਹੁਤ ਅੱਛੀ ਆ ਚਾਰ ਪੰਜ ਦਿਨ ਆਰਾਮ ਨਾਲ ਕੱਢ ਜਾਂਦੇ ਆ ਅਤੇ ਇਹਨਾਂ ਦੀ ਕੋਸਟ ਵੀ ਬਹੁਤ ਹੀ ਘੱਟ ਹੈ ਬਹੁਤ ਹੀ ਸਸਤੇ ਮਤਲਬ ਪ੍ਰੋ ਪ੍ਰੋ ਸੀਰੀਜ਼ ਵੀ ਬਹੁਤ ਹੀ ਵਧੀਆ ਪ੍ਰਾਈਜ਼ ਦੇ ਵਿੱਚ ਮਿਲ ਜਾਂਦੀ ਆ ਇਹ ਬਾਕੀ ਕੰਪਨੀਆਂ ਨਾਲੋਂ ਬਹੁਤ ਅੱਛੇ ਨੇ ਮੈਨੂੰ ਤਾਂ ਇਹਨਾਂ ਦੀ ਸਾਊਡ ਕੁਆਲਿਟੀ ਬਹੁਤ ਗੁੱਡ ਲੱਗੀ ਕਿਉਂਕਿ ਇਹ ਬਹੁਤ ਵਾਰ ਗਿਰ ਵੀ ਚੁੱਕੇ ਨੇ ਤਾਂ ਵੀ ਉਦਾਂ ਦੇ ਉਦਾਂ ਹੀ ਆ ਨਾਲ ਮੈਨੂੰ ਕੁਛ ਇਹਨਾਂ ਦੇ ਏਅਰਬਰਡਸ ਦੇ ਰਬੜਸ ਵੀ ਮਿਲੀਆਂ ਸੀ ਉਹ ਵੀ ਬਹੁਤ ਹੀ ਅੱਛੀਆਂ ਮੈਂ ਇਹਨਾਂ ਨੂੰ ਚੇਂਜ ਕਰ ਸਕਦੀ ਹਾਂ ਵਾਰ ਵਾਰ ਆਪਣੇ ਅਕੋਰਡਿੰਗਲੀ ਕਲਰ ਵੀ ਬਹੁਤ ਪਿਆਰਾ ਇਹਨਾਂ ਦਾ ਵਾਈਟ ਕਲਰ ਦੇ ਵਿੱਚ ਲਏ ਸੀ ਬਹੁਤ ਹੀ ਅੱਛਾ ਕਲਰ ਅਤੇ ਇਹਨਾਂ ਦਾ ਹੋਰ ਵੀ ਬਹੁਤ ਓਪ ਵਧੀਆ ਨੇ ਕੋਸਟ ਵੀ ਇਹਨਾਂ ਦੀ ਬਹੁਤ ਹੀ ਘੱਟ ਆ ਅਤੇ ਜਿਵੇਂ ਬਹੁਤ ਹੀ ਵਧੀਆ ਲੋਅ ਕੋਸ 'ਤੇ ਮੈਨੂੰ ਮਿਲ ਗਏ ਅਤੇ ਬਹੁਤ ਹੀ ਅੱਛੀ ਕੁਆਲਿਟੀ ਆ ਬਹੁਤ ਹੀ ਗੁੱਡ ਕੁਆਲਿਟੀ ਦੇ ਨੇ